ਹਾਂਜੀ ਸਰ ਮੈਂ ਆਪਣੀ ਮੈਂ ਆਪਣੀ ਪੜ੍ਹਾਈ ਪੰਜ ਸਾਲਾਂ ਦੀ ਉਮਰ ਵਿੱਚ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕੀਤੀ ਸੀ ਜਿੱਥੇ ਟੀਚਰ ਬਹੁਤ ਵਧੀਆ ਸਨ ਉੱਥੇ ਮਿਡ ਡੇ ਮੀਲ ਦਾ ਵੀ ਬਹੁਤ ਵਧੀਆ ਪ੍ਰਬੰਧ ਸੀ ਅਤੇ ਬਹੁਤ ਖੇਡਣ ਨੂੰ ਬਹੁਤ ਵਧੀਆ ਗਰਾਉਂਡ ਸਨ ਅਤੇ ਉੱਥੇ ਦਾ ਮਾਹੌਲ ਬਹੁਤ ਵਧੀਆ ਸੀ ਅਤੇ ਮੈਂ ਆਪਣੀ ਪੰਜਵੀਂ ਕਲਾਸ ਤੋਂ ਬਾਅਦ ਛੇਵੀਂ ਕਲਾਸ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀ ਪਿੰਡ ਤੀੜਾ ਵਿੱਚੋਂ ਕੀਤੀ ਹੈ ਜਿੱਥੇ ਕਿ ਸਾਰੀਆਂ ਮੈ ਮੈਡਮਾਂ ਬਹੁਤ ਵਧੀਆ ਪੜ੍ਹਾਉਂਦੀਆਂ ਸਨ ਮੈਂ ਕਬੱਡੀ ਵੀ ਖੇਡਦਾ ਰਿਹਾਂ ਉਹ ਸਕੂਲ ਵਿੱਚ ਉਸ ਸਕੂਲ ਦਾ ਪੀ ਟੀ ਅਧਿਆਪਕ ਬਹੁਤ ਵਧੀਆ ਸਿਖਲਾਈ ਦਿੰਦਾ ਸੀ ਇਸ ਸਕੂਲ ਵਿੱਚ ਮੈਂ ਸੀਨੀਅਰ ਸੈਕੰਡਰੀ ਤੱਕ ਦੀ ਸਿੱਖਿਆ ਪੂਰੀ ਕੀਤੀ ਹੈ ਇਸ ਸਕੂਲ ਦਾ ਮਾਧਿਅਮ ਪੰਜਾਬੀ ਸੀ ਪਰ ਹੋਰ ਵਿਸ਼ਿਆਂ ਦੇ ਅਧਿਆਪਕ ਵੀ ਇੱਥੇ ਵਧੀਆ ਪੜ੍ਹਾਉਂਦੇ ਸਨ